ਸਤਿ ਸ਼੍ਰੀ ਅਕਾਲ ਸਰ ਮੇਰਾ ਨਾਂ ਰਾਘਵ ਹੈ ਮੈਂ ਪਠਾਨਕੋਟ ਸ਼ਹਿਰ ਦਾ ਰਹਿਣ ਵਾਲਾ ਹਾਂ ਸਾਡੇ ਪਠਾਨਕੋਟ ਵਿੱਚ ਕਈ ਤਰ੍ਹਾਂ ਦੀ ਗੇਮਾਂ ਅਤੇ ਟੂਰਨਾਮੈਂਟ ਹੁੰਦੇ ਹਨ ਜਿਨ੍ਹਾਂ ਵਾਸਤੇ ਸਾਨੂੰ ਸਿਆਸੀ ਸਿਆਸੀ ਸਮੂਹ ਅਤੇ ਸੰਗਠਨਾਂ ਤੋਂ ਪਰਮਿਸ਼ਨਾਂ ਲੈਣੀਆ ਪੈਂਦੀਆਂ ਹਨ ਅਤੇ ਉਹਨਾਂ ਨੂੰ ਉਸ ਦਾ ਬਜਟ ਦੱਸਣਾ ਪੈਂਦਾ ਹੈ ਜਦੋਂ ਉਹਨਾਂ ਨੂੰ ਦੱਸੀਏ ਦੱਸਦੇ ਹਾਂ ਕਿ ਇਸ ਜਗ੍ਹਾ 'ਤੇ ਇਹ ਤਰੀਕ ਕਰਨ ਟੂਰਨਾਮੈਂਟ ਕਰਵਾਉਣਾ ਹੈ ਤਾਂ ਉਹ ਆਪਣੇ ਸੰਗਠਨ ਵਿੱਚ ਸਲਾਹ ਕਰਕੇ ਉਸ ਨੂੰ ਪਾਸ ਕਰਦੇ ਹਨ ਫਿਰ ਉਸ ਦੇ ਹਿਸਾਬ ਨਾਲ ਬਜਟ ਬਣਾਇਆ ਜਾਂਦਾ ਹੈ ਜਿਸ ਵਿੱਚ ਜਿਹੜੇ ਚੀਫ ਗੈਸਟ ਬੁਲਾਉਣੇ ਹੈ ਉਹਨਾਂ ਨੂੰ ਕਿੰਨੇ ਪੈਸੇ ਦੇਣੇ ਹਨ ਅਤੇ ਪ੍ਰਾਈਜ ਮਨੀ ਕਿੰਨੀ ਰੱਖਣੀ ਹੈ ਜਾਂ ਕਿਹੜੀਆਂ ਕਿਹੜੀਆਂ ਖੇਡਾਂ ਖਿਲਾਉਣੀਆਂ ਹਨ ਇਸ ਤਰ੍ਹਾਂ ਦੀ ਸਲਾਹ ਹੁੰਦੀ ਹੈ ਇਹ ਸਭ ਹੋਣ ਤੋਂ ਬਾਅਦ ਉਸ ਉਸ ਦਿਨ ਦੀ ਤਾਰੀਕ ਫਾਈਨਲ ਕੀਤੀ ਜਾਂਦੀ ਹੈ ਫਾਈਨਲ ਹੋਣ ਤੋਂ ਬਾਅਦ ਉਸ ਦਿਨ ਜ ਸਾਰੇ ਵੱਖਰੀ ਵੱਖਰੀ ਟੀਮਾਂ ਕਈ ਗੇਮਾਂ ਦੇ ਵਿੱਚ ਭਾ ਭਾਗ ਲੈਂਦੀਆਂ ਹਨ ਅਤੇ ਜਿਹੜੀ ਟੀਮ ਜਿੱਤਦੀ ਹੈ ਉਸ ਨੂੰ ਜੋ ਚੀਫ ਗੈਸਟ ਬੁਲਾਇਆ ਜਾਂਦਾ ਹੈ ਉਸ ਦੇ ਦੁਆਰਾ ਕਈ ਇਨਾਮ ਦਵਾਏ ਜਾਂਦੇ ਹਨ ਅਤੇ ਇਹਨਾਂ ਖੇਡਾਂ ਨਾਲ ਸਾਡੇ ਸ਼ਹਿਰ ਦਾ ਬਹੁਤ ਵਿਕਾਸ ਹੁੰਦਾ ਹੈ ਅਤੇ ਸਾਡੇ ਸ਼ਹਿਰ ਵਿੱਚ ਕਈ ਦੂਰੋਂ ਦੂਰੋਂ ਲੋਕ ਇਹਨਾਂ ਨੂੰ ਦੇਖਣ ਆਉਂਦੇ ਹਨ ਅਤੇ ਕਈ ਕਾਲਜਾਂ ਦੇ ਬੱਚੇ ਵੀ ਇਹਨਾਂ 'ਚ ਭਾਗ ਲੈਂਦੇ ਹਨ ਜਿਸ ਨਾਲ ਇਹਨਾਂ ਸਮੂਹ ਦੀ ਵੀ ਮਸ਼ਹੂਰੀ ਹੋ ਜਾਂਦੀ ਹੈ ਇਸ ਕਰਕੇ ਹੁਣ ਜਦੋਂ ਇਲੈਕਸ਼ਨਾਂ ਦੇ ਟਾਈਮ 'ਤੇ ਇਹ ਚੀ ਬਹੁਤ ਜ਼ਿਆਦਾ ਟੂਰਨਾਮੈਂਟ ਹੁੰਦੇ ਹਨ ਸਾਨੂੰ ਵੀ ਇਹਨਾਂ ਟੂਰਨਾਮੈਂਟ 'ਚ ਭਾਗ ਲੈਣਾ ਚਾਹੀਦਾ ਹੈ